ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲਦੀ ਹਾਂ ਜਿਸ ਤਰ੍ਹਾਂ ਤੁਸੀਂ ਪੁੱਛਿਆ ਕਿ ਖੇਤੀਬਾੜੀ ਲਈ ਵਰਤੇ ਜਾਣ ਵਾਲੇ ਵੱਖ ਵੱਖ ਸਾਧਨ ਜਿਸ ਤਰ੍ਹਾਂ ਕਿ ਪਹਿਲਾਂ ਲੋਕ ਸੰਗ ਬਲਦਾਂ ਦੇ ਨਾਲ ਖੇਤੀਬਾੜੀ ਕਰਦੇ ਖੇਤੀ ਦੇ ਕਰਦੇ ਸੀਗੇ ਹੁ ਗੱਡੇ ਹੁੰਦੇ ਸੀਗੇ ਔਰ ਰੇਹੜੀ ਵਗੈਰਾ ਹੁੰਦੀ ਸੀ ਹੁਣ ਖੇਤੀਬਾੜੀ ਦਾ ਟਰੈਂਡ ਬਦਲ ਗਿਆ ਟਰੈਂਡ ਹੁਣ ਤਾਂ ਲੋਕ ਮਸ਼ੀਨੀ ਜ਼ਿਆਦਾ ਵਰਤੋਂ ਕੀਤੀ ਜਿਸ ਤਰ੍ਹਾਂ ਕਿ ਟਰੈਕਟਰ ਵਗੈਰਾ ਟਰਾਲੀ ਹੈ ਉਸਦੇ ਨਾਲ ਕੀਤੀ ਜਾਂਦੀ ਹੈ ਔਰ ਜਦ ਕਣਕ ਵ ਫਸਲ ਕੱਟਣੀ ਹੁੰਦੀ ਹੈ ਤਾਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਕੰਬਾਈਨ ਵਗੈਰਾ ਇਸ ਤਰ੍ਹਾਂ ਹੀ ਲੋਕ ਹੁਣ ਉਹਨਾਂ ਦੀ ਸੰਭਾਲ ਵੀ ਕਰਨੀ ਹੁੰਦੀ ਹੈ ਜਿਸ ਤਰ੍ਹਾਂ ਪਹਿਲਾਂ ਲੋਕ ਬਲਦਾਂ ਵਗੈਰਾ ਨੂੰ ਪੱਠੇ ਵਗੈਰਾ ਪਾਉਂਦੇ ਸੀਗੇ ਹੁਣ ਲੋਕ ਮਸ਼ੀਨਾਂ ਨੂੰ ਤੇਲ ਲਗਾ ਦਿੰਦੇ ਇਸ ਤਰ੍ਹਾਂ ਟ੍ਰੈਂਡ ਬਦਲ ਗਿਆ ਲੋਕ ਹੌਲੀ ਹੌਲੀ ਬਹੁਤ ਅੱਗੇ ਅੱਗੇ ਯੁੱਗ ਬਦਲੀ ਜਾਂਦਾ ਫਿਰ ਹੁਣ ਕੁਛ ਅਗਾਂਹ ਨੂੰ ਕੁਛ ਆ ਜਾਣਾ ਅਸਾਂ ਇੱਥੇ ਜਿਸ ਤਰ੍ਹਾਂ ਬੱਚਿਆਂ ਦੀ ਸਮਝ ਵਧਦੀ ਜਾਂਦੀ ਅਸਾਂ ਅਸਾਂ ਅੱਗੇ ਅੱਗੇ ਚੀਜ਼ਾਂ ਬਦ ਬਦਲੀਆਂ ਜਾਂਦੀਆਂ ਓਕੇ ਥੈਂਕ